ਹੈਲੋ ਹਾਂਜੀ ਸਰ ਨਮਸਕਾਰ ਜੀ ਸਰ ਮੈਨੂੰ ਐਕਚੁਲੀ ਮੈਨੇ ਇਨਕੁਇਰੀ ਕਰਨੀ ਸੀ ਮੈਨੇ ਮੈਂ ਪਹਿਲਾਂ ਆਪਣੀ ਰ ਮੈਂ ਇੱਕ ਐਕਚੁਲੀ ਫਰੀਲੈਨਸਰ ਆ ਅਤੇ ਠੀਕ ਹੈ ਜੀ ਅਤੇ ਮੈਨੇ ਪਹਿਲਾਂ ਕਦੇ ਰਜਿਸਟਰੇਸ਼ਨ ਆਪਣੀ ਜੀ ਐਸ ਟੀ 'ਚ ਕਦੇ ਰਜਿਸਟਰੇਸ਼ਨ ਨਹੀਂ ਕਰਵਾਇਆ ਅਤੇ ਮੈਂ ਚਾਹੁੰਦਾ ਕਿ ਮੈਂ ਰਜਿਸਟਰੇਸ਼ਨ ਕਰਾਵਾਂ ਕਿਉਂਕਿ ਮੈਨੂੰ ਅੱਗੇ ਲੋਨ ਲਈ ਅਪਲਾਈ ਕਰਨਾ ਸੀ ਇਸ ਲਈ

ਮੈਨੇ ਲੋਨ ਲਈ ਅਪਲਾਈ ਕਰਨਾ ਸੀ ਅਤੇ ਮੈਨੂੰ ਚਾਹੀਦਾ ਸੀ ਗਾ ਕਿ ਮੈਂ ਜੀ ਐਸ ਟੀ ਭਰਾਂ ਅਤੇ ਇਸ ਲਈ ਮੈਨੂੰ ਤੁਹਾਡੇ ਤੋਂ ਕੰਸਲਟ ਕਰਨਾ ਪੈਣਾ ਕਿ ਆਪਾਂ ਨੂੰ ਕਿੰਨੇ ਕੁ ਕਿਆ ਕਿਆ ਆਪਾਂ ਨੂੰ ਚਾਹੀਦਾ ਹੈ ਇਹਦੇ ਵਿੱਚ ਰਿਕੁਾਇਰਮੈਂਟ ਕਿਆ ਨੇ ਕਿਹੜੇ ਡਾਕੂਮੈਂਟ ਲੱਗਦੇ ਹੁੰਦੇ ਨੇ ਅਤੇ ਇਸ ਤੋਂ ਇਲਾਵਾ ਆਪਾਂ ਨੂੰ ਕਿੰਨਾ ਕੁ ਟੈਕਸ ਭਰਨਾ ਚਾਹੀਦਾ ਕਿੰਨਾ ਨਹੀਂ ਕਿੰਨਾ ਕੁ ਮਤਲਬ ਆਪਾਂ ਨੂੰ ਚਾਹੀਦਾ ਮਤਲਬ ਇਸ ਤੋਂ ਜ਼ਿਆਦਾ ਵੀ ਆਪਾਂ ਨੂੰ ਬਾਅਦ ਦੇ ਵਿੱਚ ਕੋਈ ਦਿੱਕਤ ਨਾ ਆ ਸਕੇ

ਅਤੇ ਬਾਕੀ ਜੋ ਵੀ ਬਾਕੀ ਤੁਹਾਨੂੰ ਜੋ ਜਾਣਕਾਰੀ ਚਾਹੀਦੀ ਹੈ ਕੋਈ ਡਾਕੂਮੈਂਟਰੀ 'ਚ ਤੁਸੀਂ ਮੈਨੂੰ ਮੇਰੇ ਵ੍ਹਾਟਸਐਪ ਨੰਬਰ ਨੋ ਪੰਜ ਤਿੰਨ ਜੀਰੋ ਸੱਤ ਛੇ ਅੱਠ ਛੇ ਨੌਂ ਅੱਠ ਅੱਠ 'ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਮੈਂ ਤੁਹਾਨੂੰ ਆਪਣੇ ਡਾਕੂਮੈਂਟ ਦਾ ਆਪਣੇ ਦਸਤਾਵੇਜਾਂ ਦਾ ਜੋ ਆਪਣਾ ਡਿਜੀਟਲ ਫੋਰਮ ਹੈ ਉਹ ਤੁਹਾਨੂੰ ਮੈਂ ਸੈਂਡ ਕਰ ਦੂੰਗਾ ਅਤੇ ਠੀਕ ਹੈ ਸਰ ਬਸ ਇੰਨੀ ਕੁ ਗੱਲ ਕਰਨੀ ਸੀ ਓਕੇ